ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਇੱਥੇ ਦਿੱਲੀ ਤੋਂ ਆਈ ਹੋਈ ਹਾਂ ਇੱਥੇ ਘੁੰਮਣ ਫਿਰਨ 'ਤੇ ਅਤੇ ਅਸੀਂ ਇੱਥੇ ਅੱਠ ਦਸ ਦਿਨ ਰਹਿਣਾ ਹੈ ਅਤੇ ਅਸੀਂ ਫਿਰ ਆਪਣਾ ਖਾਣ ਪੀਣ ਦੀ ਸੁਵਿਧਾ ਇਹ ਸਾਰੀਆਂ ਚੀਜ਼ਾਂ ਮਤਲਬ ਦੇਖਣਾ ਚਾਹੁੰਦੇ ਹਾਂ ਪੁੱਛਣਾ ਚਾਹੁੰਦੇ ਹਾਂ ਅਸੀਂ ਨਾ ਪਾਲ ਢਾਬੇ ਬਾਰੇ ਬਹੁਤ ਸੁਣਿਆ ਹੋਇਆ ਇੱਥੇ ਤੁਹਾਡੇ ਏਰੀਏ ਤੁਹਾਡੇ ਏਰੀਏ ਦੇ ਵਿੱਚ ਅਤੇ ਤੁਸੀਂ ਮੈਨੂੰ ਦੱਸੋਂਗੇ ਸੁਝਾਓ ਦਿਉਂਗੇ ਤੁਸੀਂ ਵੀ ਇੱਥੇ ਕਿੱਦਾਂ ਦੀ ਇੱਥੇ ਸਰਵਿਸ ਹੈ ਅੱਛਾ ਜੀ ਜੀ ਜੀ ਹੋਰ ਕੋਈ ਮੁਸ਼ਕਲ ਨਹੀਂ ਆਉਂਦੀ ਉੱਥੇ ਉੱਥੇ ਬੈਠਣ ਉੱਠਣ ਦੀ ਗਰਮੀ ਤਾਂ ਨਹੀਂ ਹੈਗੀ ਅੰਦਰ ਲੱਗਦੀ ਏ ਸੀ ਲੱਗੇ ਹੋਏ ਹੈ ਜੀ ਕਿੱਦਾਂ ਸਾਰਾ ਅੱਛਾ ਜੀ ਅੱਛਾ ਜੀ